ਹੈਲੋ ਸਤਿ ਸ਼੍ਰੀ ਅਕਾਲ ਕਿਵੇਂ ਹੋ ਮੈਂ ਤੁਹਾਡੇ ਤੋਂ ਇੱਕ ਕੰਮ ਸੀ ਮੈਨੂੰ ਮੈਂ ਤੁਹਾਨੂੰ ਇਹ ਪੁੱਛਣਾ ਸੀਗਾ ਕਿ ਮੈਨੂੰ ਥੋੜ੍ਹੇ ਦਿਨ ਪਹਿਲਾਂ ਈਮੇਲ ਦੇ ਇੱਕ ਈਮੇਲ ਆਈ ਸੀ ਉਹਦੇ ਵਿੱਚ ਲਿਖਿਆ ਸੀਗਾ ਤੁਸੀਂ ਆਧਾਰ ਬਾਇਓਮੈਟਰਿਕ ਆਪਣਾ ਅਪਡੇਟ ਕਰਵਾਓ ਅਤੇ ਉਹ ਮੈਨੂੰ ਪਤਾ ਨਹੀਂ ਹੈ ਕਿੱਥੋਂ ਕਰਵਾਉਣਾ ਤਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਮੈਂ ਕਿੱਥੋਂ ਕਰਵਾਵਾਂ ਅਤੇ ਕਿਵੇਂ ਹੋਊਗਾ ਇਹ ਸਹੀ ਹਾਂਜੀ ਹਾਂਜੀ ਹਾਂਜੀ ਹਾਂਜੀ ਓਕੇ ਨਹੀਂ ਸੇਵਾ ਕੇਂਦਰ ਜਾਂ ਡਾਕਖਾਨੇ ਘਰ ਵਿੱਚ ਹੋ ਸਕਦਾ ਇਹ ਹਾਂਜੀ ਹਾਂਜੀ ਓਕੇ ਸੇਵਾ ਕੇਂਦਰ 'ਚ ਹੋਜੂ ਸੇਵਾ ਕੇਂਦਰ ਦੇ ਵਿੱਚ ਜਾ ਕੇ ਉਹਦੇ ਕੋਲ ਕਿਹਦੇ ਕੋਲ ਜਾਣਾ ਪਊਗਾ ਕੋਈ ਫਾਰਮ ਵਗੈਰਾ ਫਿ ਭਰਨਾ ਪੈਣਾ ਗਾ ਪਹਿਲਾਂ ਫਿਰ ਫਾਈਲ ਜਮ੍ਹਾਂ ਹੋਊਗੀ ਜਾਂ ਕਿਵੇਂ ਅੱਛਾ ਫਾਰਮ ਪਹਿਲਾਂ ਭਰਨਾ ਪੈਣਾ ਅਤੇ ਫਿਰ ਜਮ੍ਹਾਂ ਕਰਵਾਉਣੀ ਪੈਣੀ ਹੈ ਅੱਛਾ ਓਕੇ ਟੋਕਨ ਵਗੈਰਾ ਲੈਣਾ ਪੈਣਾ ਠੀਕ ਓਕੇ ਠੀਕ ਹੈ ਠੀਕ ਹੈ ਧੰਨਵਾਦ